ਪੰਜਾਬ ਖੇਤੀਬਾੜੀ ਦਾ ਦੇਸ਼ ਹੈ ਪੰਜਾਬ ਵਿੱਚ ਹਰ ਤਰ੍ਹਾਂ ਦੀ ਖੇਤੀਬਾੜੀ ਕੀਤੀ ਜਾਂਦੀ ਹੈ ਪੰਜਾਬ ਵਿੱਚ ਜਿਵੇਂ ਝੋਨਾ ਕਣਕ ਮੱਕੀ ਹਰ ਤਰ੍ਹਾ ਦੀ ਬੀਜ ਬੋਏ ਜਾਂਦੇ ਹਨ ਅਤੇ ਜੋ ਕਿ ਬ ਬੜੇ ਵਧੀਆ ਹੀ ਉੱਗਦੇ ਹਨ ਪੰਜਾਬ ਵਿੱਚ ਕਣਕ ਦਾ ਸਮਾਂ ਹੁੰਦਾ ਹੈ ਅਪ੍ਰੈਲ ਜਾਂ ਮਾਰਚ ਦਾ ਜਦੋਂ ਕਣਕ ਬਹੁਤ ਹੀ ਵਧੀਆ ਹੁੰਦੀ ਹੈ ਨਾਲੇ ਕਿਸਾਨਾਂ ਨੂੰ ਬਹੁਤ ਹੀ ਲਾਭਦਾਇਕ ਲਾਭ ਫ਼ਾਇਦਾ ਹੁੰਦਾ ਹੈ ਜੇਕਰ ਗੱਲ ਕੀਤੀ ਜਾਵੇ ਕਣਕ ਨੂੰ ਜੇ ਆਪਾਂ ਬਾਕੀ ਮੁਲਕਾਂ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਉੱਥੇ ਕਣਕ ਉਗਾਉਣ ਨਾਲ ਉਹਨਾਂ ਨੂੰ ਦੋ ਸੌ ਹੈਕਟਰ ਦੇ ਹਿਸਾਬ ਨਾਲ ਹੀ ਖਰਚਾ ਮਿਲਦਾ ਸਾਡੇ ਪੰਜਾਬ ਵਿੱਚ ਖਰਚਾ ਇੱਦਾਂ ਮਿਲਦਾ ਹੈ ਜਿਵੇਂ ਕਿ ਕਿਸਾਨ ਜਿੰਨੀ ਆਪਣੀ ਕਣਕ ਬੋਂ ਬੀਜਦਾ ਹੈ ਉਸ ਹਿਸਾਬ ਨਾਲ ਹੀ ਉਸ ਨੂੰ ਕਣਕ ਦਾ ਖਰਚਾ ਮਿਲਦਾ ਹੈ ਕਿਉਂਕਿ ਉਸ ਹਿਸਾਬ ਨਾਲ ਉਹ ਕਿਸਾਨ ਕਣਕ ਆਪਣੀ ਬਹੁਤ ਹੀ ਵਧੀਆ ਬੀਜਦਾ ਹੈ ਨਾਲੇ ਸਾਡੀ ਕਣਕ ਤਾਂ ਵੱਖਰੇ ਵੱਖਰੇ ਦੇਸ਼ਾਂ ਵਿੱਚ ਵੀ ਜਾਂਦੀ ਹੈ ਇੱਥੋਂ ਇੰਡੀਆ ਤੋਂ ਐਕਸਪੋਰਟ ਹੁੰਦੀ ਹੈ ਜੋ ਕਿ ਸਾਡੀ ਕਣਕ ਵਿਚ ਨਾ ਕੋਈ ਮਿਲਾਵਟ ਹੁੰਦੀ ਹੈ ਨਾ ਕੁਛ ਨਾ ਸਾਰੇ ਬਸ ਔਰਗੈਨਿਕ ਖੇਤੀ ਕੀਤੀ ਜਾਂਦੀ ਹੈ ਇਸ ਕਰਕੇ ਜੋ ਕਿ ਸਾ ਸਾਰੇ ਵਾਸਤੇ ਬਹੁਤ ਹੀ ਵਧੀਆ ਹੁੰਦੀ ਹੈ ਜਾਂ ਲਾਭਦਾਇਕ ਸਾ ਹੁੰਦੀ ਹੈ ਸਾਬਤ ਹੁੰਦੀ ਹੈ ਜਿਸ ਕਾਰਣ ਜਿਸ ਕਾਰਣ ਵਸ਼ ਕਰਕੇ ਸਾਨੂੰ ਪੰਜਾਬ ਨੂੰ ਵਧੀਆ ਦਰਜਾ ਦਿੱਤਾ ਗਿਆ ਹੈ ਖੇਤੀਬਾੜੀ ਦਾ ਜੇਕਰ ਅਸੀਂ ਹੋਰ ਵੀ ਕੁਝ ਗੱਲਾਂ ਕਰੀਏ ਤਾਂ ਪੰਜਾਬ ਵਿੱਚ ਹਰ ਤਰ੍ਹਾਂ ਦੀ ਖੇਤੀ ਔਰਗੈਨਿਕ ਹੀ ਹੁੰਦੀ ਹੈ ਜਿਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਲੋਕਾਂ ਦੇ ਉੱਤੇ ਲੋਕ ਵਧੀਆ ਰਹਿੰਦੇ ਹਨ ਅਤੇ ਤੰਦਰੁਸਤ ਰਹਿੰਦੇ ਹਨ